ਸਮਾਰਟ ਫੋਨ ਇਹ ਮੋਬਾਇਲ ਫੋਨ ਇੰਟਰਨੈਟ ਐਪਸ ਨਾਲ ਅਤੇ ਕਨੈਕਟੀਵਿਟੀ ਦੀ ਸਹੂਲਤ ਦਿੰਦਾ ਹੈ ਸਮਾਰਟ ਸਪੀਕਰ ਇਹ ਯੰਤਰ ਆਵਾਜ਼ ਅਤੇ ਹੁਕਮਾਂ ਨਾਲ ਕੰਮ ਕਰਦੇ ਹਨ ਸਮਾਟ ਟੀਵੀ ਇਹ ਟੀਵੀ ਇੰਟਰਨੈੱਟ ਨਾਲ ਕੰਨੈਕਟ ਹੋ ਸਕਦਾ ਹੈ ਅਤੇ ਆਨਲਾਈਨ ਕੰਟੈਂਟ ਦੇਖਣ ਦੀ ਸਹੂਲਤ ਦਿੰਦਾ ਹੈ ਜਿਵੇਂ ਯੂਟੀਊਬ ਨੈੱਟਫਲਿਕਸ ਆਦਿ ਰੋਬਟ ਵੈਕਇਊਮ ਕਲੀਨਰ ਸਮਾਰਟ ਲਾਈਟਿੰਗ ਸਿਸਟਮ ਇਹ ਬੱਤੀਆਂ ਨੂੰ ਸਮਾਰਟਫੋਨ ਜਾਂ ਆਵਾਜ਼ ਹੁਕਮਾਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਸਮਾਰਟ ਫ੍ਰਿਜ ਇਹ ਫਰਿੱਜ ਇੰਟਰਨੈਟ ਨਾਲ ਕਨੈਕਟ ਹੋ ਸਕਦਾ ਹੈ ਅਤੇ ਰਸੋਈ ਦੀ ਸਥਿਤੀ ਜਾਂ ਸ਼ਾਪਿੰਗ ਲਿਸਟ ਬਣਾਉਣ ਦੀ ਸਹੂਲਤ ਦਿੰਦਾ ਹੈ ਹੈਲਥ ਟਰੈਕਿੰਗ ਡਿਵਾਈਸ ਫਰਨਸ ਬੈਂਡ ਜਾਂ ਸਮਾਰਟ ਵੋਚਾ ਜਿਵੇਂ ਪਿਟ ਐਪਲ ਵੈ ਜੋ ਸਰੀਰ ਜੋ ਸਰੀਰਕ ਗਤੀਵਿਧੀਆਂ ਦਿਲ ਦੀ ਧੜਕਣ ਨੀਂਦ ਆਦਿ ਨੂੰ ਟਰੈਕ ਕਰਦੇ ਹਨ